ਹੈਲੋ ਹਾਂਜੀ ਹਾਂਜੀ ਹਾਂਜੀ ਦੱਸੋ ਮੈਡਮ ਅੱਛਾ ਜੀ ਠੀਕ ਹੈ ਮੈਡਮ ਹਾਂਜੀ ਹਾਂਜੀ ਦੇ ਇੱਕ ਮਿੰਟ ਮੈਡਮ ਤੁਹਾਨੂੰ ਦੇਖ ਕੇ ਦੱਸ ਦੇਗੇ ਕੀ ਬੂਕਿੰਗ ਹੋਈ ਆ ਵਿਆਹਾਂ ਦਾ ਸੀਜਨ ਫਿਰ ਉਹਦੇ ਕਰਕੇ ਹਾਂਜੀ ਬੂਕਿੰਗ ਜਿਆਦੇ ਕਿੰਨਾ ਦੱਸਿਆ ਮੈਡਮ ਤੁਸੀਂ ਕਿਹੜੀ ਡੇਟ ਹੈ ਅੱਛਾ ਹਾਂਜੀ ਹਾਂਜੀ ਫਰੀ ਹੈ ਮੈਡਮ ਦੱਸੋ ਕੀ ਕੰਮ ਕਰਵਾਉਣਾ ਤੁਸੀਂ ਅੱਛਾ ਜੀ ਹਾਂਜੀ ਕਿੰਨੇ ਕੀ ਨਾਮ ਸੀ ਜੀ ਉਹਨਾਂ ਦਾ ਹਾਂਜੀ ਹਾਂਜੀ ਹਾਂ ਗਏ ਸੀਗੇ ਸਾਡਾ ਹੀ ਸੀਗਾ ਸੀ ਜੀ ਉਥੇ ਠੀਕ ਹੈ ਮੈਡਮ ਠੀਕ ਹੈ ਮੈਡਮ ਹਾਂਜੀ ਵੀ ਆਪਣਾ ਕੱਲਾ ਪ੍ਰੀ ਵੈਡਿੰਗ ਦਾ ਹੀ ਹੋਊਗਾ ਕੰਮ ਜਾਂ ਵੀ ਆਪਣਾ ਮੈਰਿਜ ਦਾ ਸਾਰਾ ਕਰਨਾ ਹੋਊਗਾ ਜੀ ਠੀਕ ਹੈ ਹਾਂਜੀ ਨਹੀਂ ਨਹੀਂ ਮੈਡਮ ਉਹ ਆਪਣੇ ਨਾ ਵੀ ਜਗ੍ਹਾ ਨਾ ਕੁਛ ਸਲੈਕਟਡ ਕਰਕੇ ਰੱਖੀਆਂ ਹੁੰਦੀਆਂ ਨੇਗੀਆਂ ਸਾਰੇ ਸਟੂਡੀਓ ਨੇ ਆਪਾਂ ਫਿਰ ਉਨਾ ਜਗ੍ਹਾ ਤੇ ਲੈ ਜਾਂਦੇ ਹੁੰਦੇ ਆਗੇ ਵੀ ਜਿਹੜੇ ਆਪਣੇ ਕਸਟਮਰ ਹੁੰਦੇ ਆਪਾਂ ਦਿਖਾ ਦਿੰਨੇ ਆਗੇ ਹਨਾ ਵੀ ਉਹਨਾਂ ਦੇ ਅਕੋਰਡਿੰਗ ਵੀ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਹਨਾ ਤੇ ਵੀ ਉਹ ਹਾਂਜੀ ਫਿਰ ਆਪਾਂ ਜੀਵਨ ਉਹਨਾਂ ਦੀ ਪਸੰਦ ਆਉਂਦਾ ਉਹਨਾਂ ਦੋ ਤਿੰਨ ਸਾਈਟ ਹੈਗੀਆਂ ਨੇ ਸਾਡੇ ਆਪਦੇ ਡਿਸਟਰਿਕਟ ਦੀ ਵੀ ਆਪਾਂ ਉੱਥੇ ਕਰਵਾ ਲੈਦੇ ਹੁੰਦੇ ਹੈਗੇ ਜੀ ਤੁਸੀਂ ਹਾਂਜੀ ਉਹ ਤੁਸੀਂ ਨਾ ਵੀ ਦੇਖ ਲਿਓ ਵੀ ਤੁਹਾਨੂੰ ਅਸੀਂ ਦੱਸ ਦਾਂਗੇ ਤੇ ਵੀ ਜੇ ਤੁਹਾਨੂੰ ਵਧੀਆ ਲੱਗੂ ਜਿਹੜੀ ਜਗ੍ਹਾ ਆਪਾਂ ਉਹ ਸਲੈਕਟ ਕਰਕੇ ਉਥੇ ਤੁਹਾਡੀ ਪ੍ਰੀ ਵੈਡਿੰਗ ਹੋ ਜੁਂਗੀ ਚਾਰਜਿਸ ਤਾਂ ਮੈਡਮ ਆਏ ਹਾਂ ਮੈਡਮ ਦੇਖੋ ਵੀ ਜਿਵੇਂ ਹੁਣ ਤੁਸੀਂ ਕੰਮ ਜਿੰਨਾ ਕਰਾਉਣਾ ਹੈਗਾ ਹਨਾ ਵੀ ਕਿੰਨਾ ਕਿੰਨਾ ਕੰਮ ਹੋਊਗਾ ਜਾਂ ਵੀ ਐਲਬਮ ਦਾ ਹੋ ਗਿਆ ਵੀਡੀਓ ਦਾ ਹੋ ਗਿਆ ਹਨਾ ਪ੍ਰੀ ਵੈਡਿੰਗ ਦਾ ਇਹ ਅਲੱਗ ਅਲੱਗ ਚਾਰਜ ਹੁੰਦਾ ਹੈਗਾ ਮੈਡਮ ਫਿਰ ਵੀ ਕਿਹੋ ਜਿਹਾ ਕੰਮ ਕਰਾਉਣਾ ਤੁਸੀਂ ਉਹ ਫਿਰ ਹੁਣ ਤੁਸੀਂ ਇੱਥੇ ਜਦੋਂ ਆਓਗੇ ਅਸੀਂ ਤੁਹਾਨੂੰ ਦੱਸਾਂਗੇ ਵੀ ਆਹ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਉਹ ਅਲੱਗ ਅਲੱਗ ਹੋਗਾ ਮੈਡਮ ਆ ਕੇ ਹੀ ਪਤਾ ਲੱਗੂਗਾ ਚਾਰਜ ਦਾ ਹਨਾ ਹਾਂਜੀ ਉਹ ਤਾਂ ਦੇਖੋ ਕੰਮ ਦੇ ਅਕੋਰਡਿੰਗ ਆਪਾਂ ਕਰ ਹੀ ਦਿੰਨੇ ਹੁੰਦੇ ਆਗੇ ਹੈ ਤਾਂ ਤੁਹਾਨੂੰ ਅਸੀਂ ਔਫਟ ਵੀ ਦੇਵਾਂਗੇ ਮੰਨ ਲੋ ਤੁਸੀਂ ਸਾਰਾ ਕੰਮ ਕਰਵਾਉਦੇ ਹੋ ਸਾਡੇ ਤੋਂ ਵੀ ਜਿਵੇਂ ਜਿਹੜੇ ਕਪਲ ਦੀ ਮੈਰਿਜ ਹੋਊਗੀ ਅਸੀਂ ਉਹਨਾਂ ਦੇ ਕਪਲ ਵੀ ਤੁਹਾਨੂੰ ਫੋਟੋ ਲਾ ਕੇ ਬਣਾ ਕੇ ਦੇ ਦਾਂਗੇ ਇੱਕ ਉਹਨਾਂ ਦੀ ਪੂਰੀ ਫੁੱਲ ਸਾਈਜ ਦੀ ਫੋਟੋ ਵੀ ਦੇਵਾਂਗੇ ਤੁਹਾਨੂੰ ਬਣਾ ਕੇ ਗਿਫਟ ਦੇ ਵਜੋਂ ਹਾਂਜੀ ਤੇ ਮੈਡਮ ਇਹੀ ਜੀ ਕੋਈ ਗੱਲ ਨਹੀਂ ਵੀ ਆਪਾਂ ਕੰਮ ਪੂਰਾ ਵਧੀਆ ਕਰਾਂਗੇ ਤੁਸੀਂ ਅੱਗੇ ਵੀ ਕਿਸੇ ਨੂੰ ਕਹੁੰਗੇ ਕਿ ਉਹਨਾਂ ਤੋਂ ਕਰਾਓ ਜਿਵੇਂ ਤੁਹਾਨੂੰ ਕਿਹਾ ਹੈਗਾ ਹਾਂਜੀ ਹਾਂ ਮੈਡਮ ਤੇ ਕੋਈ ਗੱਲ ਨਹੀਂ ਜੀ ਤੁਸੀਂ ਸਾਨੂੰ ਵੀ ਬਾਕੀ ਆਇਆ ਨਾ ਮੈਡਮ ਜਿਹੜਾ ਵੀ ਪੇਮੈਂਟ ਦੀ ਗੱਲ ਹੁੰਦੀ ਹੈ ਇਹ ਕੰਮ ਹੀ ਇਦਾਂ ਦਾ ਹੈਗਾ ਵੀ ਕਈ ਵਾਰੀ ਵੱਧ ਘੱਟ ਜਾਂ ਕਿਵੇਂ ਹਨਾ ਵੀ ਆਪਾਂ ਆਈਡੀਆ ਤਾਂ ਹਾਂਜੀ ਤੇ ਹੋਰ ਕੋਈ ਗੱਲ ਨਹੀਂ ਜੇ ਮੈਡਮ ਬਾਕੀ ਐ ਵੀ ਜਦੋਂ ਤੁਸੀਂ ਆਓਗੇ ਨਾ ਤੁਹਾਨੂੰ ਕੰਮ ਦਿਖਾ ਦਾਂਗੇ ਵੀ ਕਈ ਵਾਰੀ ਆਪਾਂ ਨੂੰ ਹਾਂਜੀ ਹਾਂਜੀ ਹੋਰ ਵੀ ਵਧੀਆ ਕੰਮ ਮਿਲ ਜਾਂਦਾ ਦੇਖ ਕੇ ਤੁਹਾਨੂੰ ਲੱਗੂਗਾ ਵੀ ਇਹੋ ਜਿਹਾ ਕਰੋਨਾ ਅਸੀਂ ਹਨਾ ਫਿਰ ਉਹਦੇ ਅਕੋਰਡਿੰਗ ਵੀ ਪੇਮੈਂਟ ਦਾ ਹਾਂਜੀ ਕਰਨਾ ਪੈਂਦਾ ਹੈਗਾ ਤੇ ਬਾਕੀ ਕੋਈ ਗੱਲ ਨਹੀਂ ਮੈਡਮ ਤੁਸੀਂ ਜਦੋਂ ਆਓਗੇ ਆਪਾਂ ਤੋਂ ਜਿੰਨਾ ਵੀ ਹੋਊਗਾ ਹਨਾ ਤੁਹਾਡਾ ਅਸੀਂ ਲੈਸ ਜਰੂਰ ਕਰਾਂਗੇ ਹਾਂਜੀ ਹਾਂਜੀ ਤੁਸੀਂ ਜਰੂਰ ਆਏ ਹੋ ਮੈਡਮ ਤੇ ਹਾਂਜੀ ਆ ਕੇ ਆਪਾਂ ਫਾਈਨਲ ਕਰ ਦਾਂਗੇ ਤੇ ਕਿੰਨੀ ਦੱਸੀ ਸੀਗੀ ਤੁਸੀਂ ਡੇਟ ਗਿਆਰਾਂ ਹਾਂਜੀ ਗਿਆਰਾਂ ਨਵੰਬਰ ਠੀਕ ਹੈ ਮੈਡਮ ਲਿਖ ਲੈਨੇ ਯਾਦ ਰਹਿ ਜਾਂਦਾ ਜੀ ਹਾਂਜੀ ਹਾਂ ਹਾਂਜੀ ਹਾਂਜੀ ਤੁਸੀਂ ਹਾਂਜੀ ਆ ਕੀ ਪਤਾ ਲੱਗੂਗਾ ਬਾਕੀ ਤੁਸੀਂ ਇੱਕ ਵਾਰੀ ਆ ਜਾਓ ਤੇ ਫਿਰ ਆਪਾਂ ਫਾਈਨਲ ਹੋ ਜੁਗਾ ਓਕੇ ਮੈਡਮ ਓਕੇ